ਕੁਛ ਦਿਨਾਂ ਪਹਿਲਾਂ ਮੈਂ ਫਲਿਪਕਾਰਟ ਤੋਂ ਇੱਕ ਸਕੂਲ ਬੈਗ ਔਡਰ ਕੀਤਾ ਸੀ ਕਿ ਕਿਉਂਕਿ ਮੈਨੂੰ ਸਕੂਲ ਬੈਗ ਦੀ ਵਾਹਵਾ ਲੋੜ ਸੀ ਆਪਣੇ ਸਕੂਲ ਵਾਸਤੇ ਉਸ ਫਲਿਪਕਾਰਟ 'ਤੇ ਮੈਂ ਜਦੋਂ ਦੇਖਿਆ ਸੀ ਉਹਦੀ ਰੇਟਿੰਗ ਕਾਫੀ ਹਾਈ ਚੱਲਣ ਡਈ ਸੀ ਅਤੇ ਨਾਲ ਉਹ ਦੀ ਕੁਆਲਿਟੀ ਵੀ ਵਾਹਵਾ ਵਧੀਆ ਦੱਸਿਆ ਕਰਦੇ ਸੀ ਪਰ ਜਦੋਂ ਅੱਜ ਸਕੂਲ ਬੈਗ ਮੇਰੇ ਘਰ ਡਿਲੀਵਰਡ ਹੋਇਆ ਅਤੇ ਮੈਂ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਉਹਦੀ ਸੱਚਾਈ ਦਾ ਪਤਾ ਚੱਲਿਆ ਕਿ ਉਹ ਰੇਟਿੰਗ ਤਾਂ ਫੇਕ ਨਿਕਲੀ ਕਿਉਂਕਿ ਇਸ ਦੀ ਕੁਆਲਿਟੀ ਵਾਹਵਾ ਬੁਰੀ ਸੀ ਅਤੇ ਇਹਦਾ ਕੱਪੜਾ ਵੀ ਵਾਹਵਾ ਖੁਸ਼ਕੀ ਖੁਸ਼ਕੀ ਸੀ ਇਹ ਇਹ ਦੀ ਜ਼ਿੱਪ ਵੀ ਟੁੱਟੀ ਹੋਈ ਨਿਕਲੀ ਅਤੇ ਫਿਰ ਮੈਨੂੰ ਕਾਫੀ ਬੁਰਾ ਲੱਗਿਆ ਕਿਉਂਕਿ ਮੈਂ ਸਾਢੇ ਅੱਠ ਸੌ ਰੁਪਈਆ ਲਾ ਕੇ ਆਹ ਬੈਗ ਨੂੰ ਮੰਗਵਾਇਆ ਸੀ ਅਤੇ ਫਿਰ ਮੈਂ ਉਸ ਵੇਲੇ ਹੀ ਫਲਿਪਕਾਰਟ 'ਤੇ ਕੰਪਲੇਟ ਕੀਤੀ ਕਿ ਆਹ ਬੈਗ ਵਾਪਸ ਲਓ ਅਤੇ ਮੈਨੂੰ ਮੇਰੇ ਪੈਸੇ ਵਾਪਸ ਕਰੋ ਅਤੇ ਉਹਦੇ ਵਿੱਚ ਵੀ ਫਲਿਪਕਾਰਟ ਕਾਫੀ ਨਾਕਾਮ ਰਿਹਾ ਕਿਉਂਕਿ ਉਹ ਕਹਿੰਦਾ ਕਿ ਉਹ ਪੰਜ ਦਿਨ ਲਾਉਗਾ ਅਤੇ ਫਿਰ ਵਾਪਸ ਕਰੂਗਾ ਅਤੇ ਪੈਸੇ ਰੀਫੰਡ ਵਾਸਤੇ ਵੀ ਉਹ ਥੋੜ੍ਹੇ ਦਿਨਾਂ ਦਾ ਟਾਈਮ ਲੈਂਦਾ ਸੀ ਅਤੇ ਫਿਰ ਮੈਨੂੰ ਪਤਾ ਚੱਲਿਆ ਕਿ ਰੇਟਿੰਗ ਵੱਲ ਦੇਖ ਕੇ ਸਾਨੂੰ ਕੋਈ ਚੀਜ਼ ਔਡਰ ਨਹੀਂ ਕਰਨੀ ਚਾਹੀਦੀ ਸਾਨੂੰ ਪਹਿਲਾਂ ਪੂਰੇ ਧਿਆਨ ਨਾਲ ਪੂਰੀ ਜਾਣਕਾਰੀ ਲੈ ਕੇ ਔਡਰ ਕਰਨੀ ਚਾਹੀਦੀ ਹੈ